ਮੈਨੂੰ ਆਪਣੀ ਲਿਖਤ ਲਈ ਕਿਸੇ ਵੀ ਰਣਨੀਤੀਆਂ ਜਾਂ ਤਕਨੀਕੀ ਚੀਜ਼ਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ ਮੇਰੀ ਲਿਖਤ ਵਾਸਤੇ ਮੈਨੂੰ ਕੁਦਰਤ ਸੱਭਿਆਚਾਰ ਅਤੇ ਭਾਵਨਾਵਾਂ ਅਤੇ ਸਮਾਜ ਦੇ ਵਿ ਵਿੱਚ ਆਲੇ ਦੁਆਲੇ ਹੋਣ ਵਾਲੀਆਂ ਘਟਨਾਵਾਂ ਹੀ ਅਸਰ ਕਰਦੀਆਂ ਹਨ